ਹੈਲੋ ਜੀ ਸ਼ਗੁਨ ਢਾਬੇ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੇ ਇੱਕ ਓਡਰ ਕੀਤਾ ਸੀ ਸ਼ਾਹੀ ਪਨੀਰ ਅਤੇ ਚਾਰ ਰੋਟੀਆਂ ਦਾ ਜੀ ਮੈਂ ਤੁਹਾਡੇ ਇਸ ਲਈ ਪੁੱਛ ਰਿਹਾ ਕਿਉਂਕਿ ਮੇਰੇ ਕੋਲ ਜੋ ਮੇਰੇ ਰਿਸ਼ਤੇਦਾਰ ਆਏ ਨੇ ਉਹ ਥੋੜ੍ਹਾ ਜਲਦੀ 'ਚ ਨੇ ਵਟ ਮੈਂ ਇੱਕ ਨਾਲ ਦੀ ਨਾਲ ਟਰੈਕ ਵੀ ਕਰ ਰਿਹਾ ਮੈਨੂੰ ਉਹ ਟਰੈਕ ਨਹੀਂ ਹੋ ਰਿਹਾ ਕਿਉਂਕਿ ਡਰਾਈਵਰ ਦੀ ਡੀਟੇਲ ਹੈ ਜਾਂ ਤੁਹਾਡਾ ਡਿਲੀਵਰੀ ਲੜਕਾ ਹੈ ਉਹਦੀ ਵੀ ਡੀਟੇਲ ਮੇਰੇ ਕੋਲ ਕੋਈ ਸ਼ੋਅ ਨਹੀਂ ਹੋ ਰਹੀ ਅਤੇ ਕ੍ਰਿਪਾ ਕਰਕੇ ਮੇਰੀ ਇਸ 'ਚ ਮਦਦ ਕਰ ਸਕਦੇ ਹੋ ਕਿਉਂਕਿ ਇਸ ਟਾਈਮ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਰਿਸ਼ਤੇਦਾਰ ਜੋ ਵੀ ਆਏ ਉਨ੍ਹਾਂ ਨੂੰ ਟਾਈਮ ਸਮੇਂ ਸਿਰ ਖਾਣਾ ਖਵਾ ਕੇ ਉਨ੍ਹਾਂ ਨੂੰ ਭੇਜ ਸਕਾਂ ਅਤੇ ਪਲੀਜ਼ ਮੈਨੂੰ ਫੂਡ ਓਡਰਿੰਗ ਦੀ ਡੀਟੇਲ ਦੱਸ ਦਿੱਤੀ ਜਾਵੇ